ਹਾਂਜੀ ਜੇਕਰ ਸਾਲ ਭਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਮੋ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਖੇਤਰ ਵਿੱਚ ਜੀਰੀ ਅਤੇ ਕਣਕ ਦੋਨਾਂ ਫਸਲਾਂ ਦਾ ਜ਼ਿਆਦਾਤਰ ਖੇਤੀ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਗਰਮੀ ਦੇ ਮੌਸਮ ਵਿੱਚ ਹੀ